ਔਰਤਾਂ ਨੂੰ ਰੋਜ਼ਾਨਾ ਦੇ ਆਧਾਰ 'ਤੇ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਔਰਤਾਂ ਜੋਬਾਂ ਕਰਦੀਆਂ ਨੇ ਉਹਦੇ ਵਿੱਚ ਵੀ ਉਹਨਾਂ ਨੂੰ ਆਉਣ ਜਾਣ 'ਚ ਕਾਫੀ ਪ੍ਰੋਬਲਮ ਆਉਂਦੀ ਆ ਵੀ ਮਤਲਬ ਬਹੁਤ ਤਰ੍ਹਾਂ ਦੀ ਦੁਨੀਆਂ ਮਿਲਦੀ ਆ ਮ ਬਾਹਰ ਉਹਨਾਂ ਨੂੰ ਉਸ 'ਚ ਕੋਈ ਕਿ ਕਿਸ ਤਰ੍ਹਾਂ ਦਾ ਇਨਸਾਨ ਮਿਲਦਾ ਕੋਈ ਕਿਸ ਤਰ੍ਹਾਂ ਦਾ ਉਹ ਮ ਚੰਗੇ ਮਾੜੇ ਹਾਲਾਤਾਂ ਦੇ ਵਿੱਚ ਚੁਣੌਤੀਆਂ ਉਹਨਾਂ ਨੂੰ ਸਾਹਮਣੇ ਮ ਮਿਲਦੀਆਂ ਨੇ ਬਾਕੀ ਪਿਛਲੇ ਸਾਲਾਂ ਵਿੱਚ ਜਿਹੜੀ ਔਰਤ ਦੀ ਹੈ ਸਮਾਜ ਵਿੱਚ ਭੂਮਿਕਾ ਉਹ ਬਦਲੀ ਤਾਂ ਹੈ ਮਤਲਬ ਜਿਸ ਤਰ੍ਹਾਂ ਪੜ੍ਹਾਈਆਂ ਦੇ ਵਿੱਚ ਔਰਤਾਂ ਅੱਗੇ ਹੋਈਆਂ ਨੇ ਲੜਕੀਆਂ ਜਿਹੜੀਆਂ ਜੋਬਾਂ ਦੇ ਵਿੱਚ ਵੀ ਅੱਗੇ ਆ ਹਰ ਇੱਕ ਖੇਡ ਦੇ ਮੈਦਾਨ ਵਿੱਚ ਹਰ ਇੱਕ ਤਰ੍ਹਾਂਂ ਦੇ ਖੇਤਰ ਦੇ ਵਿੱਚ ਔਰਤ ਆ ਜਿਹੜੀ ਉਹ ਸਮਾਜ ਵਿੱਚ ਉਹਨਾਂ ਦੀ ਭੂਮਿਕਾ ਬਦਲੀ ਆ ਬਾਕੀ ਜਿਹੜਾ ਔਰਤਾਂ ਨੇ ਇਹ ਸੁਰੱਖਿਅਤ ਮਹਿਸੂਸ ਕਰਦੀਆਂ ਤਾਂ ਹੈ ਪਰ ਇੰਨਾਂ ਨਹੀਂ ਵੀ ਜਿਸ ਤਰ੍ਹਾਂ ਬਾਹਰ ਇਕੱਲੀ ਲੜਕੀ ਜਾਂਦੀ ਆ ਕਿੰਨੇ ਉਹਨਾਂ ਦੇ ਨਾਲ ਰੇਪ ਵਗੈਰਾ ਹੁੰਦੇ ਨੇ ਕੰਮ 'ਤੇ ਵੀ ਜਾਂਦੀਆਂ ਨੇ ਉਹ ਜਦੋਂ ਮ ਜਾਣੀ ਇੰਨੀ ਸੁਰੱਖਿਆ ਮਹਿਸੂਸ ਨਹੀਂ ਕਰਦੀਆਂ ਹੈਗੀਆਂ ਬਾਕੀ ਜਿਹੜੀ ਸਿੱਖਿਆ ਜਿਹੜੀ ਇਹਨਾਂ ਦੇ ਤਾਂ ਮੌਕੇ ਆ ਜਿਹੜੇ ਇਹਨਾਂ ਨੂੰ ਬਰਾਬਰ ਮਿਲਦੇ ਨੇ ਪਰ ਸੁਰੱਖਿਆ ਦੇ ਤੌਰ 'ਤੇ ਇਹਨਾਂ ਨੂੰ ਕੋਈ ਹਜੇ ਪੂਰਾ ਇੰਨਾਂ ਕਾਨੂੰਨ ਵਿਵਸਥਾ ਪੂਰੀ ਨਹੀਂ ਮਤਲਬ ਮਿਲ ਰਹੀ ਹੈਗੀ